ਕੁਝ ਸਿਹਤਮੰਦ ਪਕਵਾਨ ਕੀ ਹੁੰਦਾ ਹੈ ਸਿਹਤਮੰਦ ਪਕਵਾਨ ਜੋ ਅਸੀਂ ਇਸ ਖੋਏ ਦੀਆਂ ਪਿੰਨੀਆਂ ਹੋ ਗਈਆਂ ਅਤੇ ਅਸੀਂ ਜੋ ਸਾਨੂੰ ਸਿਹਤ ਵਾਸਤੇ ਬਹੁਤ ਫਾਇਦਾ ਹੁੰਦਾ ਖੋਏ ਦੀਆਂ ਪਿੰਨੀਆਂ ਪੁਰਾਣੇ ਕਦੇ ਅਸੀਂ ਏ ਗਜਰੇਲਾ ਬਣਾ ਲਿਆ ਕਦੇ ਕਦੇ ਖੋਆ ਮਾਰ ਲਿਆ ਕਦੇ ਅਸੀਂ ਆਪਣਾ ਜੋ ਵੀ ਪਕਵਾਨ ਅਤੇ ਆਪਣਾ ਉਹਦਾ ਸਿਹਤ ਵਾਸਤੇ ਬਹੁਤ ਫਾਇਦਾ ਹੁੰਦਾ ਹੈ ਅਤੇ ਸਾਨੂੰ ਅਸੀਂ ਆਪਣਾ ਗਜਰੇਲਾ ਗਰ ਗਜਰੇਲਾ ਬਣਾਉਣਾ ਕਦੇ ਅਸੀਂ ਆਪਣਾ ਕੋਈ ਫਲ ਫਲੂ ਹੋ ਗਏ ਅਤੇ ਸਿਹਤ ਵਾਸਤੇ ਇਹ ਕਦੇ ਗੁਲਗੁਲੇ ਬਹੁਤ ਬਣਾਉਣੇ ਕਦੇ ਅਸੀਂ ਆਪਣਾ ਖੋਏ ਤੋਂ ਖੋਏ ਦੀਆਂ ਪਿੰਨੀਆਂ ਕੱਢ ਲੈਣੀਆ ਅਤੇ ਦੁੱਧ ਪਨੀਰ ਪਨੀਰ ਉਹ ਕਰ ਲਵਾਂ ਮਟਰ ਮਟਰ ਪਨੀਰ ਬਣਾ ਲੈਣੇ ਅਸੀਂ ਅਤੇ ਆਪਣਾ ਉਹ ਤੋਂ ਬਾਅਦ ਸੋਇਆ ਸੋਇਆਬੀਨ ਦੀਆਂ ਸੋਇਆਬੀਨ ਦਾ ਉਹ ਕਰ ਲੈਣਾ ਇਹ ਕਾਜੂ ਬਦਾਮ ਪਾ ਕੇ ਕਦੇ ਅਸੀਂ ਆਪਣਾ ਗਜਰੇਲਾ ਵੀ ਆਪਣਾ ਬਣਾ ਲੈਣਾ ਇਸ ਤਰ੍ਹਾਂ ਹੀ ਆਪਣੀ ਸਿਹਤ ਵਾਸਤੇ ਜੋ ਵੀ ਸਾਨੂੰ ਵਧੀਆ ਹੁੰਦਾ ਅਤੇ ਅਸੀਂ ਆਪਣਾ ਲ ਲੱਡੂ ਲੱਡੂ ਬਣਾ ਲੈਂਦੇ ਸਿਹਤ ਵਾਸਤੇ ਅਤੇ ਲ ਲੱਡੂ ਵੀ ਖਾਣ ਨੂੰ ਸਵਾਦ ਹੁੰਦੇ ਆ ਇਹ ਅਤੇ ਇਹ ਆਪਣਾ ਓਕੇ